ਹਾਂ ਮੇਰਾ ਐਕਪੋਜੀਟਿਵ ਐਕਸਪੀਰੀਅਸ ਇਹੀ ਹ ਕਿ ਮੈਂ ਮਤਲਵ ਐਲੋਵੇਰਾ ਜੈਲ ਇੱਕ ਬਾਰੀ ਯੂਜ਼ ਕੀਤੀ ਸੀਗੀ ਮੇਰਾ ਬਹੁਤ ਅੱਛਾ ਐਕਸਪੀਰੀਸ ਰਿਹਾ ਆ ਜਿੰਦਗੀ ਦਾ ਕੀ ਮੈਂ ਸੁਣਿਆ ਸੀ ਉਸ ਬਾਰੇ ਕਿ ਉਹਨੂੰ ਲਾ ਲੋ ਤਾ ਤੁਸੀਂ ਜੀ ਤੁਹਾਡੇ ਮੂੰਹ ਤੇ ਦਾਣੇ ਨਹੀਂ ਹੁੰਦੇ ਤੁਹਾਡੀਆਂ ਛਾਹੀਆਂ ਠੀਕ ਹੋ ਜਾਂਦੀਆਂ ਤੁਹਾਡੇ ਰਿੰਕਲਸ ਠੀਕ ਹੋ ਜਾਂਦੀ ਬਾਬਾ ਰਾਮਦੇਵ ਦੀ ਬੜੀ ਐਡ ਸੁਣੀ ਸੀਗੀ ਤਾਂ ਉਦਾਂ ਵੀ ਬਹੁਤ ਜਿਆਦਾ ਸੁਣਿਆ ਟੀ ਵੀ 'ਚ ਐਡ 'ਚ ਫੋਨ 'ਚ ਪਰ ਮੈਨੂੰ ਪਤਾ ਨਹੀਂ ਸੀਗਾ ਮੈਂ ਮੰਨਦੀ ਨਹੀਂ ਸੀ ਇਸ ਚੀਜ਼ ਨੂੰ ਪਰ ਫਿਰ ਜਦੋਂ ਮੈਂ ਐਲੋਵੇਰਾ ਜੈਲ ਸੱਚੀ ਮੁੱਚੀ ਯੂਜ਼ ਕੀਤੀ ਆਪਣੇ ਘਰ ਲਾਇਆ ਉਹਦਾ ਬੂਟਾ ਤੁਹਾਡੇ ਸਾ ਉਥੋਂ ਹੀ ਡਰੈਕਟ ਤੋੜ ਕੇ ਆਪਣੇ ਫੇਸ ਤੇ ਲਾਈ ਮਹੀਨਾ ਦੋ ਮਹੀਨੇ ਲਾਉਂਦੀ ਰਹੀ ਤਾਂ ਉਹਦੇ ਨਾਲ ਮੇਰੀਆਂ ਬਹੁਤ ਪ੍ਰੋਬਲਮ ਠੀਕ ਹੋ ਗਈਆਂ ਜਿਵੇਂ ਕਿ ਮੇਰੀ ਸਕਿੰਨ ਬਹੁਤ ਸਾਫ ਹੋ ਗਈ ਮੇਰਾ ਇਕ ਦਮ ਚਿਹਰਾ ਖਿਲ ਗਿਆ ਤਰੋ ਤਾਜਾ ਹੋ ਗਿਆ ਮੇਰੇ ਪਿੰਪਲਸ ਹੱਟ ਗਏ ਉਹਦੇ ਨਾਲ ਪਿਗਮੈਂਟੇਸ਼ਨ ਹੱਟ ਗਈ ਮੈਂ ਕਈਆਂ ਨੂੰ ਸੂਜੈਸਟ ਕੀਤਾ ਕੀ ਇਹ ਲਾਣੀ ਸ਼ੁਰੂ ਕਰੋ ਇਹ ਬਹੁਤ ਵਧੀਆ ਚੀਜ਼ ਆ ਮੇਰੀਆਂ ਕਈਆਂ ਸਹੇਲੀਆਂ ਨੇ ਆਂਢੀ ਗੁਆਂਢੀਆਂ ਨੇ ਵੀ ਲਾਇਆ ਤੇ ਸਭ ਨੇ ਪੋਜ਼ੀਟਿਵ ਰੀਵਿਊ ਦਿੱਤੇ ਉਹਦੇ ਕਿ ਤੇਰਾ ਤਾਂ ਐਕਸਪੀਰੀਅਂਸ ਹੀ ਬਹੁਤ ਵਧੀਆ ਆ ਇਹ ਚੀਜ਼ ਤਾਂ ਬਹੁਤ ਹੀ ਵਧੀਆ ਆ ਰਹੀ ਔਰ ਸਸਤੀ ਇਹ ਚ ਕੋਈ ਪੈਸਾ ਵੀ ਨਹੀਂ ਸਾਡਾ ਲੱਗਦਾ ਐਨਾ ਹਨਾ ਬਿਨਾਂ ਪੈਸਿਆਂ ਤੋਂ ਨਾ ਤੁਸੀਂ ਮਤਲਬ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਆ ਮੈਂ ਕਹਿੰਨੀ ਸਭ ਨੂੰ ਚੱਕਣੀ ਚਾਹੀਦੀ ਆ ਔਰ ਘਰ ਘਰ ਐਲੋਵੇਰਾ ਲਾਉਣੀ ਚਾਹੀਦੀ ਉਹਨੇ ਉਹ ਤਾਂ ਵੀ ਹੋਰ ਵੀ ਬਹੁਤ ਫਾਇਦੇ ਆ ਅਗਰ ਤੁਸੀਂ ਐਲੋਵੇਰਾ ਦੀ ਸਬਜੀ ਬਣਾ ਕੇ ਖਾਦੇ ਹੈ ਨਾ ਤਾਂ ਤੁਹਾਡੇ ਜੋੜਾ 'ਚ ਲਵਾਵ ਰਹਿੰਦਾ ਤੁਹਾਡੇ ਜੋਖ ਠੀਕ ਰਹਿੰਦੀ ਹ ਤੁਹਾਨੂੰ ਬਹੁਤ ਨੁਕ ਕੋਈ ਨੁਕਸਾਨ ਨਹੀਂ ਹੁੰਦਾ ਬਹੁਤ ਫਾਇਦੇ ਆ ਤਾਂ ਇਸ ਕਰਕੇ ਮੇਰਾ ਤਾਂ ਸਭ ਤੋਂ ਵਧੀਆ ਐਕਸਪੀਰੀਅਸ ਇਹੀ ਰਿਹਾ ਪੋਜੀਟਿਵ ਐਕਸਪੀਰੀਅਂਸ ਇਹੀ ਆ ਕਿ ਐਲੋਵੇਰਾ ਜੈਲ ਬਹੁਤ ਵਧੀਆ ਰਹੀ ਮੇਰੇ ਲਈ ਉਹ ਮੈਂ ਅੱਜ ਤੋਂ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਉਹ ਅਜੇ ਤੱਕ ਮੈਂ ਯੂਜ਼ ਕਰਦੀ ਆਂ ਔਰ ਮੈਨੂੰ ਉਹਦੇ ਕਾਫੀ ਫਾਇਦੇ ਮਿਲੇ ਆ ਉਹਦਾ ਨੁਕਸਾਨ ਮੈਨੂੰ ਕੋਈ ਨਹੀਂ ਹੋਇਆ ਫਰੀ ਦਾ ਫਰੀ ਬਿਨਾ ਪੈਸਿਆਂ ਤੋਂ ਇਨੇ ਸਾਲ ਹੋ ਗਏ ਮੈਨੂੰ ਤਿੰਨ ਕ ਸਾਲ ਹੋ ਗਏ ਯੂਜ਼ ਕਰਦੀ ਨੂੰ ਉਹ ਮੇਰੇ ਲਈ ਬਹੁਤ ਹੀ ਅੱਛੀ ਚੀਜ਼ ਰਹੀ ਆ ਮੈਂ ਹਰ ਬੰਦੇ ਨੂੰ ਕਹਿੰਦੀ ਆ ਔਰ ਬੱਚਾ ਬੁੱਢਾ ਵੱਡਾ ਜਵਾਨ ਕੋਈ ਵੀ ਯੂਜ਼ ਕਰ ਸਕਦਾ ਉਹਦਾ ਕੋਈ ਫਾਇਦਾ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਫਾਇਦਾ ਆ ਨਾ ਹੀ ਉਹਦੀ ਕੋਈ ਉਮਰ ਹੈ ਨਾ ਕੁਛ ਤਾਂ ਜਿਦਾਂ ਤੁਸੀਂ ਤੇਜ਼ ਤੇ ਦਵਾਈਆਂ ਲਾਉਂਦੇ ਮੂੰਹ ਤੇਜ਼ ਕਰੀਮ ਲਾਉਂਦੇ ਆ ਤਾਂ ਉਹਦੇ ਮੈਨੂੰ ਬੈਨੀਫਿਟ ਦੇ ਨਾਲ ਨਾਲ ਸਾਈਡ ਇਫੈਕਟ ਬਹੁਤ ਹੁੰਦੇ ਆ ਉਹ ਤੋਂ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟਸ ਆਉਂਦੇ ਆ ਤੇ ਫੇਸ ਦੀਆਂ ਕਰੀਮਾਂ ਬਹੁਤ ਮਹਿੰਗੀਆਂ ਹੁੰਦੀਆਂ ਇਹ ਸਸਤੀ ਦੀ ਸਸਤੀ ਆ ਅਤੇ ਪਿਓਰ ਅਸ਼ੁੱਧ ਆ ਔਰ ਸਾਡੇ ਬਹੁਤ ਪੂਰਵਜਾ ਦੇ ਟਾਈਮ ਦੇ ਆ ਪੂਰਵਜ ਵੀ ਸਾਡੇ ਕਹਿੰਦੇ ਹੁੰਦੇ ਸੀਗੇ ਵੀ ਭਾਈ ਐਲੋਵੇਰਾ ਯੂਜ਼ ਕਰੋ ਇਹ ਬਹੁਤ ਚੰਗੀ ਚੀਜ਼ ਆ ਇਹਨੂੰ ਪੰਜਾਬੀ 'ਚ ਕੁਆਰ ਗੰਦਲ ਕਹਿੰਦੇ ਆ ਸਾਡੀ ਇੱਥਏ ਤਾਂ ਕੁਆਰ ਗੰਦਲ ਕਹਿੰਦੇ ਆ ਇਹਨੂੰ ਯੂਜ ਕਰੋ ਤਾਂ ਇਹ ਮੈਂ ਜਦੋਂ ਯੂਜ ਕੀਤੀ ਤਾਂ ਮੈਨੂੰ ਇਹਦੇ ਬਹੁਤ ਹੀ ਫਾਇਦੇ ਹੋਏ ਆ ਮੈਂ ਕਹੂੰਗੀ ਕਿ ਹਰ ਬੰਦੇ ਨੂੰ ਯੂਜ ਕਰਨੀ ਚਾਹੀਦੀ ਆ ਇਹਦਾ ਬਹੁਤ ਹੀ ਵਧੀਆ ਰਿਜਲਟ ਆਉਂਦਾ ਆ ਇਹਦਾ ਕੋਈ ਨੁਕਸਾਨ ਨਹੀਂ ਜੇ ਤੁਹਾਨੂੰ ਫਾਇਦਾ ਨਹੀਂ ਦਊਗਾ ਤਾ ਨੁਕਸਾਨ ਕੋਈ ਨਹੀਂ ਦੇ ਕੇ ਜਾਊਗਾ ਤੇ ਤੇ ਸਭ ਨੂੰ ਯੂਜ ਕਰਨੀ ਚਾਹੀਦੀ ਆ ਇਹ ਬਿਨਾਂ ਪੈਸਿਆਂ ਤੋਂ ਆ ਇਹਦੇ ਨਾਲ ਤੁਹਾਡਾ ਰੰਗ ਸਾਫ ਹੁੰਦਾ ਰੰਗ ਨਿੱਖਰ ਦਾ ਦਾਣੇ ਠੀਕ ਹੁੰਦੇ ਛਾਈਆਂ ਠੀਕ ਹੁੰਦੀਆਂ ਹੋਰ ਕਈ ਪ੍ਰੋਬਲਮ ਤੁਹਾਡੀਆਂ ਠੀਕ ਹੁੰਦੀਆਂ ਅਗਰ ਤੁਸੀਂ ਇਹਨੂੰ ਖੁਆਉਂਦੇ ਸਬਜੀ ਬਣਾ ਕੇ ਤੁਹਾਡੀ ਇਟਰਨਲ ਪ੍ਰੋਬਲਮਾਂ ਠੀਕ ਹੁੰਦੀਆਂ ਤੁਹਾਡੇ ਗੋਡੇ ਗਿੱਟੇ ਠੀਕ ਹੁੰਦੇ ਤਾਂ ਭਾਈ ਸਾਰਿਆਂ ਲਈ ਬਹੁਤ ਵਧੀਆ ਆ